ਹਾਂਜੀ ਮੈਂ ਇੱਕ ਇਹੋ ਜਿਹੇ ਪੰਛੀ ਦਾ ਬਚਾਅ ਕੀਤਾ ਜਿਹੜਾ ਜ਼ਖਮੀ ਸੀਗਾ ਮੈਂ ਇੱਕ ਵਾਰੀ ਜਾ ਰਹੀ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਇੱਕ ਤੋਤਾ ਜਿਹੜਾ ਉਹ ਡਿੱਗਿਆ ਪਿਆ ਸੀ ਜਦੋਂ ਮੈਂ ਦੇਖਿਆ ਕਿ ਉਹਨੂੰ ਉਠਾਇਆ ਤਾਂ ਦੇਖਿਆ ਕਿ ਉਹਦੇ ਖੰਭ ਜਿਹੜੇ ਸੀਗੇ ਉਹਦੇ ਵਿੱਚ ਜ਼ਖਮ ਸੀ ਅਤੇ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਜਾਂ ਤਾਂ ਕਿਸੇ ਨੇ ਵੱਡੇ ਜਾਨਵਰ ਨੇ ਉਹਨੂੰ ਜ਼ਖਮ ਦੇ ਕੇ ਨੀਚੇ ਸੁੱਟਿਆ ਅਤੇ ਜਾਂ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ ਹੋਣਾ ਮੈਂ ਉਹਨੂੰ ਚੱਕ ਕੇ ਤੇ ਘਰ ਲੈ ਆਈ ਫਿਰ ਉਹਨੂੰ ਉਹਦੀ ਸਫਾਈ ਕੀਤੀ ਬੀਟਾਡੀਨ ਦੇ ਨਾਲ ਉਹਦੇ ਜ਼ਖਮ ਸਾਫ ਕੀਤੇ ਉਹਦੇ 'ਤੇ ਹਲਦੀ ਵਗੈਰਾ ਸੁੱਟੀ ਅਤੇ ਉਹ ਥੋੜ੍ਹਾ ਜਿਹਾ ਹੋ ਗਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਬਿਮਾਰ ਹੈ ਫਿਰ ਮੈਂ ਉਹਦੀ ਬੜੀ ਕੇਅਰ ਕੀਤੀ ਥੋੜ੍ਹੀ ਜਿਹੀ ਉਹਦਾ ਥੋੜ੍ਹਾ ਖਾਣ ਪੀਣ ਦਾ ਵੀ ਉਹਦਾ ਧਿਆਨ ਰੱਖਿਆ ਉਹਦੇ ਜ਼ਖਮਾਂ 'ਤੇ ਦੋ ਤਿੰਨ ਵਾਰੀ ਉਹ 'ਤੇ ਟਿਊਬ ਲਗਾਈ ਫੇਰ ਮੈਂ ਦੇਖਦੀ ਰਹੀ ਕਿ ਕਿਤੇ ਜ਼ਿਆਦਾ ਤਾਂ ਨਹੀਂ ਬਿਮਾਰ ਪਰ ਕੁਝ ਹੀ ਦਿਨਾਂ ਦੇ ਬਾਅਦ ਮੈਨੂੰ ਲੱਗ ਰਿਹਾ ਸੀਗਾ ਕਿ ਉਹਦਾ ਜ਼ਖਮ ਸੁੱਕਣਾ ਸ਼ੁਰੂ ਹੋ ਗਿਆ ਅਤੇ ਉਹ ਵਾਲਾ ਜਿਹੜਾ ਤੋਤਾ ਸੀਗਾ ਕੁਝ ਦਿਨਾਂ ਬਾਅਦ ਉਹ ਲੱਗ ਰਿਹਾ ਸੀਗਾ ਕਿ ਹੁਣ ਇਹ ਉੱਡ ਸਕਦਾ ਹੈ ਕਿਉਂਕਿ ਉਹਦੇ ਜ਼ਖਮ ਠੀਕ ਹੋ ਗਏ ਸੀ ਪਰ ਮੈਨੂੰ ਖੁਸ਼ੀ ਵੀ ਹੋਈ ਕਿ ਚਲੋ ਮੈਂ ਇੱਕ ਜ਼ਖਮੀ ਤੋਤੇ ਨੂੰ ਬਚਾਇਆ ਹੈ ਅਤੇ ਜਦੋਂ ਮੈਨੂੰ ਲੱਗਾ ਕਿ ਉਹ ਪ੍ਰੋਪਰ ਹੋ ਗਿਆ ਪਰ ਉਹ ਖੁਦ ਹੀ ਆਪਣੇ ਆਪ ਹੀ ਫਿਰ ਉੱਡ ਕੇ ਚਲਾ ਗਿਆ